ਕਯਾ ਕੀ ਕਹਿੰਦੇ ਅਸੀਂ ਪੁਰਾਣੇ ਹੈ ਜਿਹਨੂੰ ਅਸੀਂ ਕਹਿੰਦੇ ਹੈ ਪਿਛੋਕੜ ਉਹਦਾ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਪਿਛੋਕੜ 'ਚ ਕੀ ਸੀ ਸਾਰਾ ਪਰਿਵਾਰ ਮਿਲਕੇ ਰਹਿੰਦਾ ਸੀ ਅੱਜ ਕੱਲ੍ਹ ਕੀ ਹੈ ਸਾਰਾ ਪਰਿਵਾਰ ਬਿਖਰ ਚੁੱਕਾ ਹੈ ਇੱਕ ਪਰਿਵਾਰ ਪੰਜ ਅਗਰ ਤਿੰਨ ਬੱਚੇ ਹਨ ਮੁੰਡਾ ਜਾਂ ਕੁੜੀ ਜੋ ਵੀ ਹੈ ਦੋ ਮੁੰਡੇ ਅਤੇ ਇੱਕ ਕੁੜੀ ਜਾਂ ਤਿੰਨ ਮੁੰਡੇ ਸਾਰੇ ਜੋ ਵੀ ਹੈ ਬਿਖਰ ਚੁੱਕੇ ਆ ਸਾਰੇ ਆਪਣੇ ਆਪਣੇ ਅਲੱਗ ਅਲੱਗ ਜਗ੍ਹਾ ਦੇ ਉੱਪਰ ਨੌਕਰੀਆਂ ਕਰਦੇ ਹੈ ਜਾਂ ਆਪਣੇ ਪਰਿਵਾਰ ਨੂੰ ਪਾਲਦੇ ਹੈ ਅਗਰ ਮੰਨ ਲਓ ਅਸੀਂ ਕਹਿੰਦੇ ਹੈ ਕਿ ਇੱਕ ਨੰਬਰ ਬੱਚਾ ਦੋ ਨੰਬਰ ਬੱਚਾ ਤਿੰਨ ਨੰਬਰ ਬੱਚਾ ਤਿੰਨ ਨੰਬਰ ਬੱਚਾ ਆਪਣੇ ਬਾਪ ਮਾਂ ਦੇ ਨਾਲ਼ ਰਹਿ ਰਿਹਾ ਇੱਕ ਨੰਬਰ ਅਤੇ ਦੋ ਨੰਬਰ ਬੱਚਾ ਅਲੱਗ ਦੂਜੇ ਸ਼ਹਿਰਾਂ ਵਿੱਚ ਕੰਮ ਕਰ ਰਿਹਾ ਮਾਂ ਬਾਪ ਦੀ ਤਬੀਅਤ ਖਰਾਬ ਹੋ ਗਈ ਅਸੀਂ ਕਹਿੰਦੇ ਹੈ ਇੱਕ ਨੰਬਰ ਅਤੇ ਦੋ ਨੰਬਰ ਨੂੰ ਕਿ ਭਾਈ ਮਾਂ ਬਾਪ ਦੀ ਤਬੀਅਤ ਖਰਾਬ ਹੈ ਮੈਂ ਇਕੱਲਾ ਨਹੀਂ ਸਾਂਭ ਸਕਦਾ ਮੈਨੂੰ ਪ੍ਰੋ ਦਿੱਕਤ ਹੈ ਤੁਸੀਂ ਆ ਕੇ ਸਾਂਭ ਲਉ ਮੇਰਾ ਥੋੜ੍ਹੀ ਮੇਰੀ ਮਦਦ ਕਰੋ ਪਰ ਉਹ ਕੀ ਕਹਿੰਦੇ ਹੈ ਕਿ ਸਾਡੇ ਕੋਲ ਸਮਾਂ ਨਹੀਂ ਹੈ ਇਹੀ ਸਾਡਾ ਪਿਛੋਕੜ ਜਿਹੜਾ ਪਛਾ ਪੁਰਾਣਾ ਪਿਛੋਕੜ ਸੀ ਉਹ ਕੀ ਕਰਦੇ ਸੀ ਸਾਰੇ ਇੱਕ ਘਰ ਦੇ ਵਿੱਚ ਰਹਿੰਦੇ ਸੀ ਕਿਸੇ ਨੂੰ ਕੋਈ ਦਿੱਕਤ ਨਹੀਂ ਹੁੰਦੀ ਸੀ